ਮੋਟਰਸਸਾਈਕਲ ਚਲਾਉਣ ਵੇਲੇ ਬਹੁਤ ਜ਼ਿਆਦਾ ਹੀ ਦਿੱਕਤਾਂ ਆਉਂਦੀਆਂ ਹਨ ਜਿਸਦੇ ਵਿੱਚ ਆ ਗਿਆ ਹੈ ਖਸਤਾ ਸੜਕਾਂ ਦੀ ਹਾਲਤ ਸੜਕ ਹਿੰਦੁਸਤਾਨ ਦੇ ਵਿੱਚ ਸੜਕਾਂ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਹੈ ਹਰ ਸੜਕ 'ਤੇ ਹੀ ਤੁਹਾਨੂੰ ਹਰ ਤੀਸਰੇ ਮੋੜ 'ਤੇ ਖੱਡ ਮਿਲ ਜਾਂਦਾ ਹੈ ਜਿਸਦੇ ਕਾਰਨ ਸਾਨੂੰ ਆਪਣੇ ਬਾਈਕ ਦੇ ਸ਼ੋਕਰਾਂ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆ ਜਾਂਦੀ ਹੈ ਨਾਲ ਦੀ ਨਾਲ ਸਾਡੇ ਪਿੱਠ 'ਤੇ ਵੀ ਬਹੁਤ ਜ਼ਿਆਦਾ ਇਫੈਕਟ ਪੈ ਜਾਂਦਾ ਹੈ ਅਤੇ ਨਾਲ ਦੀ ਨਾਲ ਸਾਡੀ ਜਿਹੜੀ ਹੋਰ ਚੀਜ਼ਾਂ ਵੀ ਨੇ ਹੈ ਨਾ ਜਿਵੇਂ ਪੰਚਰ ਵਗੈਰਾ ਦੀ ਵੀ ਦਿੱਕਤ ਸਾਨੂੰ ਬਹੁਤ ਜ਼ਿਆਦਾ ਆ ਜਾਂਦੀਆਂ ਹਨ ਜਿਵੇਂ ਕਿ ਲੋਕ ਆਪਣੀ ਨੋਕੀਲੀਆਂ ਚੀਜ਼ਾਂ ਸੜਕਾਂ ਉੱਤੇ ਸੁੱਟ ਕੇ ਨਿਕਲ ਜਾਂਦੇ ਹਨ ਉਸਦੇ ਕਾਰਨ ਸਾਨੂੰ ਸਾਡੀ ਮੋਟਰਸਾਈਕਲਾਂ ਪੰਚਰ ਹੋ ਜਾਂਦੀਆਂ ਹਨ ਜਿਸਦੇ ਕਾਰਨ ਸ ਬਹੁਤ ਜ਼ਿਆਦਾ ਹੀ ਦਿੱਕਤ ਆਉਂਦੀਆਂ ਹਨ ਅਤੇ ਉਸਦਾ ਕੋਈ ਜਲਦੀ ਜਲਦੀ ਸਮਾਧਾਨ ਵੀ ਨਹੀਂ ਮਿਲਦਾ ਅਤੇ ਇ ਇਸ ਦੇ ਨਾਲ ਦੇ ਨਾਲ ਮੋ ਖਰਾਬ ਮੌਸਮ ਹੋਣ ਦੇ ਕਾਰਨ ਵੀ ਬਹੁਤ ਜ਼ਿਆਦਾ ਦਿੱਕਤ ਆਉਂਦੀਆਂ ਹਨ ਹਿੰਦੁਸਤਾਨ ਦੇ ਵਿੱਚ ਸੱਤ ਮੋ ਇੰਨੇ ਜ਼ਿਆਦਾ ਮੌਸਮ ਦੇ ਵਿੱਚ ਭਰਵੀਲੀਆਂ ਆਉਂਦੀਆਂ ਹਨ ਜਿਸਦੇ ਕਾਰਨ ਪਤਾ ਹੀ ਨਹੀਂ ਲੱਗਦਾ ਕਦੋਂ ਮੌਸਮ ਕਿਹੜੇ ਵੇਲੇ ਬਦਲ ਜਾਂਦਾ ਹੈ ਜਿਸਦੇ ਕਾਰਨ ਮੋਟਰਸਾਈਕਲ ਚਲਾਉਣ ਵੇਲੇ ਜਦੋਂ ਆਪਾਂ ਨਿਕਲਦੇ ਹਾਂ ਤਾਂ ਕੋਈ ਪਤਾ ਨਹੀਂ ਲੱਗਦਾ ਕਿ ਕਦੋਂ ਕਿੱਥੇ ਨਿਕਲ ਜਾ ਨਿਕਲ ਸਕਦੇ ਹਾਂ ਅਤੇ ਤੰਗੀਆਂ ਸੜਕਾਂ ਹਿੰਦੁਸਤਾਨ ਦੇ ਵਿੱਚ ਸੜਕਾਂ ਦੀ ਹਾਲਤ ਜ਼ਿਆਦਾ ਵਧੀਆ ਨਹੀਂ ਹੈ ਖਸਤਾ ਹੋਣ ਦੇ ਨਾਲ ਦੇ ਨਾਲ ਉਹਨਾਂ ਦਾ ਕੋਈ ਦੀਨ ਇਮਾਨ ਵੀ ਨਹੀਂ ਹੈ ਉਹ ਕ ਕਿੱਧਰੋਂ ਵੀ ਕਿੱਥੋਂ ਵੀ ਨਿਕਲ ਕੇ ਆ ਸਕਦੇ ਹਨ ਅਤੇ ਨਾਲੇ ਉਹ ਬਹੁਤ ਭੀੜੀਆਂ ਭੀੜੀਆਂ ਸੜਕਾਂ ਹੁੰਦੀਆਂ ਹਨ ਜਿਸਦੇ ਕਾਰਨ ਬੰਦਾ ਕੋਈ ਆਪਣਾ ਵਾਹੀਕਲ ਅੰਦਰ ਨਹੀਂ ਵਾੜ ਸਕਦਾ ਅਤੇ ਟਰੈਫਿਕ ਟਰੈਫਿਕ ਵੀ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਹੀ ਹੈ ਜਿਸਦੇ ਨਾਲ ਜਿਸਦੇ ਕਾਰਨ ਹਰ ਰੋਜ਼ ਕਾਫੀ ਕਈ ਕਾਫੀ ਜ ਸਾਰੇ ਐਕਸੀਡੈਂਟ ਹੁੰਦੇ ਹਨ ਜਿਸਦੇ ਕਾਰਨ ਲੋਕਾਂ ਦੀ ਮਰਨ ਦੀ ਸੰਖਿਆ ਦਿਨੋ ਦਿਨ ਹੀ ਵੱਧਦੀ ਜਾ ਰਹੀ ਹੈ ਸਰਕਾਰ ਨੇ ਇਸਦੇ ਪ੍ਰਤੀ ਕੋਈ ਖਾਸ ਸਟੈਂਡ ਨਹੀਂ ਲਿੱਤਾ ਜਿਸਦੇ ਕਾਰਨ ਉਹ ਇਸਦੇ ਸ਼ਿਕਾਰ ਹੋ ਲੋ ਆਮ ਲੋਕ ਇਸਦੇ ਸ਼ਿਕਾਰ ਹੋ ਰਹੇ ਹਨ ਜਿਸਦੇ ਨਾਲ ਨਾਲ ਜਿਵੇਂ ਹੀ ਵਧ ਕੰਮ ਹੋਵੇਗਾ ਤਾਂ ਉਹਦੇ ਨਾਲ ਹੀ ਸੜਕਾਂ ਦੀ ਹਾਲਤ ਵਧੀਆ ਹੁੰਦੀ ਜਾਵੇਗੀ ਤਾਂ ਨਾਲ ਦੀ ਨਾਲ ਸਰਕਾਰ ਦੇ ਨਾਲ ਨਾਲ ਸਰਕਾਰ ਅਤੇ ਆਮ ਲੋਕਾਂ ਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕੋਈ ਵੀ ਸਰਕਾਰੀ ਨਿਯਮ ਨਾ ਤੋੜੇ ਅਤੇ ਜਿਹੜੇ ਪੁਲਿਸ ਵਾਲੇ ਹਨ ਉਹਨਾਂ ਦਾ ਮੌਜੂਦਾ ਹੀ ਚਲਾਨ ਕਰਨ ਅਤੇ ਉਹਨਾਂ ਨੂੰ ਸਮਝਾਉਣ ਕਿ ਉਹਨਾਂ ਦੀ ਉਰੇ ਆਹ ਗਲਤੀ ਹੈ ਜਿਸਦੇ ਨਾਲ ਨਾਲ ਲੋਕਾਂ ਨੂੰ ਸਮ ਲੋਕਾਂ ਨੂੰ ਪੜ੍ਹਾਉਣਾ ਵੀ ਚਾਹੀਦਾ ਹੈ ਅਤੇ ਬੱਚਿਆਂ ਨੂੰ ਵੀ ਸਕੂਲ ਦੇ ਵਿੱਚ ਇਹਨਾਂ ਚੀਜ਼ਾਂ ਬਾਰੇ ਗਿਆਨ ਦੇਣਾ ਚਾਹੀਦਾ ਹੈ ਕਿ ਹਰ ਚੀਜ਼ ਦਾ ਮਾਨ ਸਤਿਕਾਰ ਕਰਨਾ ਜ਼ਰੂਰੀ ਹੈ ਉਹਨਾਂ ਲਈ ਇਸ ਕਰਕੇ ਸਾਨੂੰ ਇਸ ਚੀਜ਼ ਦੇ ਬਾਰੇ ਬੱਚਿਆਂ ਅਤੇ ਬਜ਼ੁਰਗ ਅਤੇ ਨੌਜਵਾਨਾਂ ਨੂੰ ਗਿਆਨ ਦੇਣਾ ਚਾਹੀਦਾ ਹੈ ਅਤੇ ਪੁਲਿਸ ਵਾਲਿਆਂ ਨੂੰ ਹਰ ਸਕੂਲ ਦੇ ਵਿੱਚ ਜਾ ਕੇ ਉਹਨਾਂ ਨੂੰ ਨੌਰਮਲ ਨੌਲੇਜ ਦੇਣੀ ਚਾਹੀਦੀ ਹੈ ਅਤੇ ਨਾਲ ਦੇ ਨਾਲ ਲੋਕਾਂ ਨੂੰ ਗਾਈਡ ਵੀ ਕਰਨਾ ਜ਼ਿਆਦਾ ਜ਼ਰੂਰੀ ਹੈ